ਹੈਲੋ

ਤੁਸੀਂ ਪਿੱਛੇ ਬੈਠੇ ਆਂ ਅਤੇ ਫਿਰ ਤੁਸੀਂ ਅੱਗੇ ਕਿਵੇਂ ਆਉਂਗੇ ਭੀੜ ਹੀ ਬੜੀ ਆ ਅਤੇ ਇੱਥੇ ਸਫਰ ਹੀ ਇੰਨੀ ਭੀੜ ਆ ਨਾ ਬਹੁਤ ਜ਼ਿਆਦਾ ਵੀ ਮੈਥੋਂ ਤਾਂ ਆਪ ਤਾਂ ਟਿਕਟਾਂ ਨਹੀਂ ਕੱਟੀਆਂ ਜਾਂਦੀਆਂ ਵਿੱਚ ਅਤੇ ਮੈਂ ਤਾਂ ਆਪ ਬਹੁਤ ਪਰੇਸ਼ਾਨ ਹੈਗੀ ਹਾਂ ਅੱਛਾ ਨਹੀਂ ਨਹੀਂ ਤੁਸੀਂ ਉਤਰੋ ਨਾ ਤੁਸੀਂ ਉਤਰੋ ਨਾ ਐਈ ਬੈਠੇ ਰਹੋ ਤੁਸੀਂ ਬੈਠੇ ਰਹੋ ਅਤੇ ਥੋੜ੍ਹੀ ਜਿਹੀ ਵਾਟ ਸਫਰ ਰਹਿ ਗਿਆ ਅਗਾਂਹ ਸਵਾਰੀਆਂ ਉਤਰਨਗੀਆਂ ਬੱਸ ਥੋੜ੍ਹੀ ਜਿਹੀ ਵਿਹਲੀ ਹੋ ਜਾਊਗੀ ਅਤੇ ਫਿਰ ਤੁਸੀਂ ਵੇਖੀ ਨਾ ਅੱਗੇ ਹੀ ਆ ਜਾਇਓ ਅਤੇ ਫਿਰ ਮੈਂ ਤੁਹਾਨੂੰ ਕਿੱਥੇ ਵਾਵਾਂ ਜਦੋਂ ਸੀਟ ਹੀ ਨਹੀਂ ਮੂਹਰੇ ਕੋਈ ਤੁਸੀਂ ਫਿਰ ਖੜ੍ਹੇ ਜਾਓਗੇ ਹੱਲ ਤਾਂ ਫਿਰ ਇਹੀ ਆ ਵੀ ਤੁਹਾਨੂੰ ਥੱਲੇ ਦੀ ਤਾਰ ਕੇ ਤੀਵੀਆਂ ਦਾ ਤਾਂ ਭਾਵੇਂ ਬਾਹਲਾ ਦਮ ਆ ਹੋਰ ਤਾਂ ਕੋਈ ਹੱਲ ਨਹੀਂ ਇੱਥੇ ਹੋ ਸਕਦਾ ਭੀੜ ਹੀ ਬੜੀ ਆ ਨੌਜਵਾਨ ਨੂੰ ਹੁਣ ਮੈਂ ਕਿਹਨੂੰ ਉਠਾਵਾਂ ਇਹ ਨੌਜਵਾਨ ਸਾਰੇ ਖੜ੍ਹੇ ਹੀ ਆ ਵਿੱਚ ਬੀਬੀਆਂ ਹੀ ਬੈਠੀਆਂ ਬੀਬੀਆਂ ਬੀਬੀਆਂ ਹੈ ਵੀ ਬਜ਼ੁਰਗ ਆ ਸਾਰੀਆਂ ਤੁਸੀਂ ਖੜ੍ਹੇ ਰਹੋ ਉੱਠ ਕੇ ਖੜ੍ਹੇ ਹੋ ਜਾਓ ਅਤੇ ਬੱਸ ਅੱਗੇ ਆਉਣ ਵਾਲਾ ਹੀ ਆ ਆਪਣਾ ਅੱਡਾ ਬੱਸ ਅੱਡਾ ਅਤੇ ਬਸ ਫਿਰ ਉੱਥੇ ਜਾ ਕੇ ਉੱਤਰ ਜਾਇਓ ਜੇ ਅਤੇ ਬੀਬੀਆਂ ਬਹੁਤ ਬੈਠੀਆਂ ਬਜ਼ੁਰਗ ਉਹਨਾਂ ਨੂੰ ਮੈਂ ਕਿੱਥੇ ਮਾਤਾ ਨੂੰ ਬਿਠਾਵਾਂ ਮਾਤਾ ਵਿਚਾਰੀਆਂ ਕਿੱਧਰ ਜਾਣਗੀਆਂ ਉਹਨਾਂ ਤੋਂ ਉੱਤਰ ਕੇ ਥੱਲੇ ਨਹੀਂ ਸੀਟਾਂ ਬਦਲੀਆਂ ਜਾਣੀਆਂ ਦੁਆਰਾ ਅੱਛਾ ਫਿਰ ਹੁਣ ਅੱਗੇ ਬਦਲ ਦਿੰਦੇ ਫਿਰ ਆ ਜਾਓ ਉਤਰ ਕੇ ਕਿਸੇ ਨੂੰ ਉੱਠਾ ਦਿੰਦੇ ਹਾਂ ਹੁਣ ਮੈਂ ਕਿਵੇਂ ਲੈ ਕੇ ਜਾਵਾਂ ਤੈਨੂੰ ਵੀ ਕਨਡਕਟਰਾਂ ਕੋਲ ਇੰਨਾ ਟੈਮ ਕਿੱਥੇ ਹੁੰਦਾ ਜਿੰਨੀਆਂ ਤੁਸੀਂ ਗੱਲ ਕਰੀ ਜਾਂਦੇ ਹਾਂ ਤੁਸੀਂ ਪਹਿਲਾਂ ਹੀ ਬਹਿਣ ਲੱਗਿਆਂ ਨਹੀਂ ਅੱਗੇ ਚੜ੍ਹਨਾ ਸੀ ਤੁਹਾਨੂੰ ਪਤਾ ਹੀ ਸੀਗਾ ਬੱਸ 'ਚ ਭੀੜ ਬਹੁਤ ਜ਼ਿਆਦਾ ਤੁਸੀਂ ਮਗਰ ਜਾਓ ਹੀ ਨਾ ਆ ਜਾ ਫਿਰ ਉਤਰ ਕੇ ਮੈਂ ਚੜ੍ਹਾ ਦਿੰਦਾ ਮੂਹਰ ਦੀ